ਭਾਰਤ ਵਿੱਚ ਅਲੱਗ ਅਲੱਗ ਪ੍ਰਾਂਤਾਂ ਵਿੱਚ ਅਲੱਗ ਅਲੱਗ ਕਲਾਵਾਂ ਹਨ ਜਿੱਦਾਂ ਕਿ ਗੁਜਰਾਤ ਦੇ ਵਿੱਚ ਗਰਬਾ ਰਾਜਸਥਾਨ ਦਾ ਝੂੰਮਰ ਅਤੇ ਹਿਮਾਚਲ ਦਾ ਹਿਮਾਚਲੀ ਡਾਂਸ ਇਹ ਬੜਾ ਹੀ ਮਸ਼ਹੂਰ ਹੈ ਜਿੱਦਾਂ ਕਿ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਪੰਜਾਬ ਦੇ ਵਿੱਚ ਭੰਗੜਾ ਅਤੇ ਗਿੱਧਾ ਬੜਾ ਹੀ ਮਸ਼ਹੂਰ ਹੈ ਜੇਕਰ ਮੈਨੂੰ ਦੂਜੇ ਦੇਸ਼ਾਂ ਨੂੰ ਦਿਖਾਉਣ ਵਿੱਚ ਇੱਕ ਦਿਨ ਦਾ ਰਾਜ ਮਿਲ ਜਾਵੇ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਭੰਗੜੇ ਦੀ ਤਾਰੀਫ਼ ਕਰਾਂਗੀ ਗਿੱਧੇ ਦੀ ਤਾਰੀਫ਼ ਕਰਾਂਗੀ ਇਹ ਸਭ ਨੂੰ ਦਿਖਾਵਾਂਗੀ ਅਤੇ ਉਸ ਤੋਂ ਬਾਅਦ ਜਿੱਦਾਂ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਲੀ ਦਿੱਤੀ ਸੀ ਉਸ ਦੇ ਬਾਰੇ ਸਭ ਨੂੰ ਸਿੱਖਿਆ ਦੇਵਾਂਗੀ ਕਿ ਉਹਨਾਂ ਨੇ ਆਪਣਾ ਕੌਮ ਦੇ ਵਾਸਤੇ ਸਾਰਾ ਪਰਿਵਾਰ ਵਾਡ ਵਾਰ ਦਿੱਤਾ ਅਤੇ ਸਾਨੂੰ ਵੀ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਣੇ ਦੇਸ਼ ਅਤੇ ਕੌਮ ਵਾਸਤੇ ਸਾਨੂੰ ਕਿੱਦਾਂ ਲੜਨਾ ਚਾਹੀਦਾ ਹੈ ਮੈਂ ਸਾਰੇ ਦੂਸਰੇ ਦੇਸ਼ ਵਿੱਚ ਜਾ ਕੇ ਉਹਨਾਂ ਨੂੰ ਆਪਣੇ ਦੇਸ਼ ਦੇ ਬਾਰੇ ਦੱਸਾਂਗੀ ਕਿ ਸਾਡੇ ਵਿੱਚ ਭੰਗੜਾ ਗਿੱਧਾ ਬੜਾ ਮਸ਼ਹੂਰ ਹੈ ਅਤੇ ਇਸ ਨੂੰ ਬੜਾ ਹੀ ਵਧੀਆ ਤਰੀਕੇ ਨਾਲ਼ ਪਾ ਕੇ ਇੱਕ ਸਾਡੀ ਇੱਕ ਐਕਸਰਸਾਈਜ਼ ਵੀ ਹੋ ਜਾਂਦੀ ਹੈ ਅਤੇ ਆਪਾਂ ਇਸ ਨੂੰ ਨਾਲ਼ ਮਨੋਰੰਜਨ ਵੀ ਕਰ ਲੈਂਦੇ ਹਾਂ ਇਹ ਦਿਖਾਉਣਾ ਚਾਹਵਾਂਗੀ ਮੈਂ ਅਤੇ ਧੰਨਵਾਦ